ਇਸ ਬਦਲਦੇ ਹੋਏ ਆਧੁਨਿਕ ਯੁੱਗ ਵਿੱਚ ਪੰਜਾਬ ਰਾਜ ਵਿੱਚ ਟੈਲੀਮੈਡੀਸਨ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਕਰੋਨਾ ਦੇ ਆਉਣ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਸੀ ਜਿਸ ਕਰਕੇ ਸਰਕਾਰ ਨੇ ਇਸ ਨੂੰ ਚਲਾਇਆ ਇਸ ਦੇ ਵਿੱਚ ਲੋਕ ਆਪਣੇ ਘਰ ਹੀ ਬੈਠੇ ਔਨਲਾਈਨ ਡੋਕਟਰਾਂ ਦੇ ਨਾਲ ਗੱਲਬਾਤ ਕਰ ਸਕਦੇ ਸੀ ਅਤੇ ਔਨਲਾਈਨ ਹੀ ਉਸਦਾ ਇਲਾਜ ਕਰਵਾ ਸਕਦੇ ਸੀ ਜਿਨ੍ਹਾਂ ਕਰਕੇ ਉਹਨਾਂ ਦੀ ਕਈ ਸਮੱਸਿਆਵਾਂ ਘੱਟ ਹੋਈਆਂ ਅਤੇ ਅੱਜ ਕੱਲ੍ਹ ਇਹ ਬਹੁਤ ਹੀ ਜ਼ਿਆਦਾ ਪ੍ਰਚੱਲਿਤ ਹੋ ਰਹੀ ਹੈ ਕਿਉਂਕਿ ਲੋਕ ਆਪਣੇ ਕੰਮਾਂ ਵਿੱਚ ਬਹੁਤ ਰੁੱਝੇ ਹੋਏ ਹਨ ਜਿਨ੍ਹਾਂ ਕਰਕੇ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਹੇ ਅਤੇ ਉਹਨਾਂ ਕੋਲ ਡੋਕਟਰਾਂ ਨੂੰ ਮਿਲਣ ਦਾ ਟਾਈਮ ਨਹੀਂ ਹੈ ਅਤੇ ਉਹ ਇਸ ਦੀ ਵਰਤੋਂ ਕਰਕੇ ਆਪਣਾ ਇਲਾਜ ਕਰਵਾ ਰਹੇ ਹਨ